ਟਰੈਕਟਰਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਅਤੇ ਬ੍ਰੈਂਡ ਹਨ ਜਿਵੇਂ ਕਿ ਮਹਿੰਦਰਾ ਫੋਰਡ ਆਈਸ਼ਰ ਸਵਰਾਜ ਹੋ ਅਤੇ ਹੋਰ ਵੀ ਬਹੁਤ ਸਾਰੇ ਕਿਸਮਾਂ ਦੇ ਟਰੈਕਟਰ ਹਨ ਇਹ ਟਰੈਕਟਰਾਂ ਦੇ ਕੇਵਲ ਬ੍ਰੈਂਡ ਹੀ ਨਹੀਂ ਇਹਨਾਂ ਦੇ ਵਿੱਚ ਵੱਖਰੇ ਵੱਖਰੇ ਮਾਡਲ ਵੀ ਆਉਂਦੇ ਨੇ ਅਤੇ ਉਹਨਾਂ ਮਾਡਲਾਂ ਦੇ ਹਿਸਾਬ ਕੁਛ ਨਾ ਕੁਛ ਬ ਹਰ ਮਾਡਲ 'ਚ ਨਵੇਂ ਤੋਂ ਨਵੇਂ ਮਾਡਲ 'ਚ ਕੁਛ ਨਾ ਕੁਛ ਬਦਲਾਵ ਹੋਇਆ ਈ ਹੁੰਦਾ ਹੈ ਅਤੇ ਉਹ ਜਦੋਂ ਬਦਲਾਵ ਹੁੰਦਾ ਹੈ ਨਵੇਂ ਤੋਂ ਨਵਾਂ ਟਰੈਕਟਰ ਆਉਂਦਾ ਹੈ ਤਾਂ ਉਹਦੇ ਵਿੱਚ ਬਹੁਤ ਸਾਰੇ ਬਦਲਾਵਾਂ ਦੇ ਕਾਰਨ ਸਾਡੇ ਸਮੇਂ ਦਾ ਜਿਹੜੀ ਉਹ ਬਹੁਤ ਸਾਰੀ ਬੱਚਤ ਹੁੰਦੀ ਹੈ ਅਤੇ ਜਿਹੜੇ ਟਰੈਕਟਰ ਆ ਉਹ ਸਾਡੀ ਜ਼ਿੰਦਗੀ ਦਾ ਇੱਕ ਅਜਿਹਾ ਸਾਧਨ ਬਣ ਗਿਆ ਵਾ ਜਿਹੜਾ ਖੇਤੀਬਾੜੀ ਦੇ ਵਿੱਚ ਬਹੁਤ ਜ਼ਿਆਦਾ ਉਪਯੋਗੀ ਆ ਜਿਵੇਂ ਕਿ ਵੇਖਿਆ ਜਾਏ ਤਾਂ ਪਹਿਲਾਂ ਜਦੋਂ ਲੋਕ ਮਤਲਬ ਉਹਦੇ ਨਾਲ ਕੰਮ ਕਰਦੇ ਸੀ ਬਲਦਾਂ ਨਾਲ ਉਦੋਂ ਉਹਨਾਂ ਨੂੰ ਬੜਾ ਟਾਈਮ ਲੱਗਦਾ ਹੁੰਦਾ ਸੀ ਅਤੇ ਹੁਣ ਖੇਤਾਂ ਵਿੱਚ ਟਰੈਕਟਰ ਆ ਗਏ ਨੇ ਅਤੇ ਉਹਦੇ ਨਾਲ ਜਿਹੜੀ ਖੇਤੀਬਾੜੀ ਕਰਨੀ ਬਹੁਤ ਸੌਖੀ ਹੋ ਗਈ ਅਤੇ ਟੈਮ ਦੀ ਬਹੁਤ ਬੱਚਤ ਹੋਣ ਲੱਗ ਗਈ ਆ ਹੁਣ ਜਦੋਂ ਆਪਾਂ ਢੋਆ ਢੁਆਈ ਦਾ ਸਾਧਨ ਬਣ ਗਿਆ ਹੈ ਜਦੋਂ ਫ਼ਸਲ ਲੈ ਕੇ ਜਾਣੀ ਹੁੰਦੀ ਜਾਂ ਸਬਜ਼ੀਆਂ ਨੂੰ ਮੰਡੀ ਦੇ ਵਿੱਚ ਲੈ ਕੇ ਜਾਣਾ ਹੁੰਦਾ ਤਾਂ ਟਰੈਕਟਰਾਂ ਦੇ ਨਾਲ ਮਿੰਟੋ ਮਿੰਟ ਆਪਾਂ ਜਿਹੜੀ ਆ ਉਹ ਸਬਜ਼ੀ ਅਤੇ ਫ਼ਸਲ ਨੂੰ ਮੰਡੀ ਦੇ ਵਿੱਚ ਲੈ ਕੇ ਜਾ ਸਕਦੇ ਹਾਂ ਅਤੇ ਇਹ ਪਹਿਲਾਂ ਜਿਵੇਂ ਕਿ ਬਲਦ ਹੀ ਰਵਾਇਤੀ ਜਿਹੜੇ ਪਿਛਲੇ ਸਮੇਂ ਸੀ ਉਹਨਾਂ ਦੇ ਵਿੱਚ ਬਲਦ ਸੀ ਉਹਨਾਂ ਦੇ ਨਾਲ ਬੜਾ ਟੈਮ ਫਿਰ ਜਿਵੇਂ ਜਿਵੇਂ ਕਿ ਬਦਲਾਵ ਆਉਂਦਾ ਗਿਆ ਉਵੇਂ ਉਵੇਂ ਹੁਣ ਟਰੈਕਟਰ ਆ ਗਏ ਨੇ ਵੱਖਰੇ ਵੱਖਰੇ ਬ੍ਰੈਂਡਾਂ ਦੇ ਅਤੇ ਉਹਨਾਂ ਦੇ ਨਾਲ ਜਿਹੜੀ ਖੇਤੀਬਾੜੀ ਅਤੇ ਕਿਸਾਨਾਂ ਦੀ ਜ਼ਿੰਦਗੀ ਉਹ ਸੌਖੀ ਹੋ ਗਈ ਆ